ਹੈਲੋ ਕਿਦਾ ਸਰ ਕਿੱਥੇ ਚੱਲੀਏ ਫਰੀਦਕੋਟ ਚਲਦੇ ਆ ਹਰੀ ਫਾਸਟ ਫੂਡ ਸਾਡੇ ਕਾਲਜ ਦੇ ਕੋਲ ਵੀ ਆ ਉਹ ਵੀ ਹੈਗੀ ਫਾਸਟਫੂਡ ਆ ਇੱਕ ਓਧਰ ਨੂੰ ਸਾਡੇ ਕਾਲਜ ਦੇ ਸਾਹਮਣੇ ਐਸ ਡੀ ਕਾਲਜ ਦੇ ਸਾਹਮਣੇ ਮੇਨ ਰੋਡ ਤੇ ਐਸ ਡੀ ਕਾਲਜ ਦੇ ਸਾਹਮਣੇ ਮੇਨ ਰੋਡ ਤੇ ਓਥੇ ਜੇ ਚੱਲ ਪੈਂਦੇ

ਹੁਸ਼ਿਆਰਪੁਰ ਚ ਫੂਡ ਮਸ਼ਹੂਰ ਹੈ ਹੁਸ਼ਿਆਰਪੁਰ ਦੇ ਫੂਡ ਕਾਫੀ ਮਸ਼ਹੂਰ ਹੁੰਦੇ ਜਿੱਥੇ ਮਰਜੀ ਚਲ ਜੋ ਸਾਰੇ ਵਧੀਆ ਮਿਲਦੇ ਓਹ ਬਰਗਰ ਖਾ ਆਉਂਦੇ ਬਰਗਰ ਜਾਂ ਹਰੀ ਫੂਡ ਫਾਸਟ ਫਾਸਟਫੂਡ ਦੇ ਆਲੂ ਦੀ ਟਿੱਕੀ ਬਰਗਰ ਬਹੁਤ ਵਧੀਆ ਹੁੰਦੇ ਆ ਇਥੇ ਸੀ

ਹਾਂ ਖਾ ਵੀ ਆਏ ਬਾਰਾਂ ਸੋ ਸੈਂਤੀ ਰੁਪਏ ਦਾ ਹੈਲੋ ਹਾਂ ਬਾਰਾਂ ਸੋ ਸੈਂਤੀ ਰੁਪਏ ਦਾ ਖਾ ਲਿਆ ਫਾਸਟ ਫੂਡ ਅੱਛਾ ਉਹ ਬਰਗਰ ਕਹਿੰਦਾ ਸੀ ਹਾਂ ਹਾਂ ਤੇ ਇਕੱਠੇ ਖਾ ਲੁਗੇ ਨਾ ਬਰਗਰ ਹੋਰ

ਹਾਂ ਉੱਥੇ ਗੁਲਾਬ ਜਾਮੁਣ ਖਾ ਕੇ ਆਉਂਗੇ ਕੀ ਸੁਣਾਊਂਗਾ ਹਾਂ ਹਾਂ ਹੋਰ ਸ਼ਾਮੇ ਚਲਦੇ ਕੱਲ ਸ਼ਾਮੀ ਹਾਂ ਹੋਰ ਹਾਂ ਉਥੇ ਪੀਜਾ ਵ

ਅੱਛਾ ਲੈ ਆਉਂਗੇ ਫਿਰ ਆਪਾਂ ਜਾ ਆਉਂਗੇ ਲੈ ਲੈ ਡੱਬਾ ਅੱਛਾ ਡੱਬਾ ਕਦੋਂ

ਠੀਕ ਹ ਡਨ ਚਲਦੇ ਫਿਰ ਬਾਏ